ਕੋਈ ਵੀ ਵਿਅਕਤੀ ਟਿਕਟਾਂ ਸਿੱਕੇ ਜਾਂ ਇਹੋ ਜਿਹੇ ਕੋਇਨ ਇਕੱਠੇ ਕਰਨ ਦਾ ਜਿਸ ਨੂੰ ਸ਼ੌਕ ਹੈ ਅੱਜ ਵੀ ਸ਼ੁਰੂ ਕਰ ਸਕਦਾ ਹੈ ਕਿਉਂਕਿ ਚੱਲਣ ਦੇ ਵਿੱਚ ਕਈ ਪੁਰਾਣੇ ਸਿੱਕੇ ਅਲੱਗ ਅਲੱਗ ਤਰ੍ਹਾਂ ਦੇ ਨੋਟ ਮਿਲ ਜਾਂਦੇ ਹਨ ਉਹਨਾਂ 'ਚੋਂ ਚੁਣ ਕੇ ਹੀ ਆਪਣੀ ਲਾਇਬਰੇਰੀ 'ਚ ਰੱਖਣਾ ਚਾਹੀਦਾ ਹੈ ਇਹ ਸ਼ੌਕ ਜਾਤੀ ਤੌਰ 'ਤੇ ਆਪਣਾ ਆਪਣਾ ਹੁੰਦਾ ਹੈ ਜ਼ਬਰਦਸਤੀ ਕਿਸੇ ਕੋਲੋਂ ਨਹੀਂ ਕਰਵਾਇਆ ਜਾ ਸਕਦਾ ਇਹ ਸ਼ੌਕ ਹੈ ਕਿਸੇ ਨੂੰ ਵੀ ਹੋ ਸਕਦਾ ਹੈ ਇਹ ਅੱਛੀ ਗੱਲ ਹੈ ਇਹ ਅਗਲੇ ਆਉਣ ਵਾਲੇ ਬੱਚਿਆਂ ਨੂੰ ਦੱਸਿਆ ਜਾ ਸਕਦਾ ਹੈ ਕਿ ਵੀ ਇਸ ਤਰ੍ਹਾਂ ਦੇ ਪੈਸੇ ਕਿਸੇ ਵੇਲੇ ਚੱਲਣ ਦੇ ਵਿੱਚ ਸੀਗੇ